ਸਤਿ ਸ਼੍ਰੀ ਅਕਾਲ ਜੀ ਨਾਇਕਾ ਤੋਂ ਗੱਲ ਕਰਦੇ ਹੋ ਆਖਰੀ ਵਾਰ ਮੈਂ ਤੁਹਾਡੇ ਐਪ ਤੋਂ ਜਿਹੜੀ ਹੈ ਇੱਕ ਜੀਨ ਔਡਰ ਕਰੀ ਸੀ ਉਹ ਜੀਨ ਦੀ ਪੈਕਿੰਜਿੰਗ ਜਿਹੜੀ ਸੀ ਉਹ ਮੈਨੂੰ ਬਹੁਤ ਹੀ ਵਧੀਆ ਲੱਗੀ ਅਤੇ ਇਹ ਜੀ ਜੀਨ ਜਿਹੜੀ ਹੈ ਮੈਂ ਫਰ ਜੂਨ ਦੇ ਵਿੱਚ ਮੰਗਵਾਈ ਸੀ ਅਤੇ ਹੁਣ ਤੱਕ ਮਤਲਬ ਉਹ ਐਨੀ ਵਧੀਆ ਚੱਲ ਰਹੀ ਹੈ ਉਹਦਾ ਕਲਰ ਵਗੈਰਾ ਐਨਾ ਵਧੀਆ ਸੀ ਕਿ ਬਹੁਤ ਅੱਛਾ ਮੇਰਾ ਜਿਹੜਾ ਤੁਹਾਡੇ ਨਾਲ ਇਹ ਜਿਹੜਾ ਐਕਸਪੀਰੀਐਂਸ ਰਿਹਾ ਹੈ ਮੈਂ ਜਿੰਨੀ ਵੀ ਚੀਜ਼ਾਂ ਔਡਰ ਕਰਦੀ ਹਾਂ ਉਹ ਬਹੁਤ ਹੀ ਵਧੀਆ ਨਿਕਲਦੀਆਂ ਹੈ ਅਤੇ ਜਿਹੜਾ ਤੁਹਾਡਾ ਡਿਲਿਵਰੀ ਬੋਆਏ ਸੀ ਉਹ ਵੀ ਬਹੁਤ ਹੀ ਚੰਗਾ ਪਰਸਨ ਸੀ ਅਤੇ ਮੇਰਾ ਜਿਹੜਾ ਤੁਹਾਡੇ ਨਾਲ ਐਕਸਪੀਰੀਐਂਸ ਰਿਹਾ ਉਹ ਬਹੁਤ ਵਧੀਆ ਰਿਹਾ ਅਤੇ ਮੈਂ ਤੁਹਾਨੂੰ ਜਿਹੜੀ ਹੈ ਹਮੇਸ਼ਾ ਪੰਜ ਚੋਂ ਪੰਜ ਜਿਹੜੀ ਹੈ ਉਹ ਰੇਟਿੰਗ ਦਿੰਦੀ ਹਾਂ